ਹਾਂਜੀ ਮੇਰੇ ਕੋਲ ਪਹਿਲੇ ਸਮੇਂ ਦੇ ਕੁਛ ਸਿੱਕੇ ਨੇ ਜਿਵੇਂ ਦੋ ਪੈਸੇ ਇੱਕ ਪੈਸੇ ਪੰਜ ਪੈਸੇ ਪੱਚੀ ਪੈਸੇ ਇਹ ਅੱਜ ਕੱਲ੍ਹ ਦੇਖਣ ਨੂੰ ਮਿਲਦੇ ਨਹੀਂ ਹੈ ਉਸ ਟਾਈਮ ਮਤਲਵ ਜਦੋਂ ਮੈਂ ਛੋਟੀ ਹੁੰਦੀ ਸੀ ਵੀਹ ਰੁਪਏ ਦੀਆਂ ਵੀਹ ਟੋਫੀਆਂ ਆ ਜਾਂਦੀਆਂ ਨੇ ਸੀ ਇੱਕ ਇੱਕ ਪੈਸੇ ਦੀ ਔਰੇਂਜ ਕਲਰ ਦੀ ਟੋਫੀ ਹੁੰਦੀ ਸੀ ਔਰੇਂਜ ਵਾਲੀ ਉਹ ਟੋਫੀ ਬੜੀ ਵਧੀਆ ਲੱਗਦੀ ਸੀ ਅਤੇ ਇੱਕ ਇੱਕ ਪੈਸੇ ਦੀ ਉਹ ਟੋਫੀ ਹੁੰਦੀ ਸੀ ਅਤੇ ਜਦੋਂ ਸਕੂਲ ਜਾਣਾ ਛੋਟੇ ਹੁੰਦੇ ਤਾਂ ਡੈਡੀ ਨੇ ਨ ਇੱਕ ਰੁਪਇਆ ਦੇ ਦੇਣਾ ਜਾਂ ਵੀਹ ਪੈਸੇ ਦੇ ਦੇਣੇ ਹੁਣ ਇਹਨਾਂ ਚੀਜ਼ਾਂ ਦੀ ਵੈਲਿਊ ਨਹੀਂ ਹੈਗੀ ਪਰ ਹੁਣ ਵੀ ਜਦੋਂ ਵੀ ਕਦੀ ਕਿਤੇ ਮੈਂ ਆਪਣੀ ਅਲਮਾਰੀ ਵਿੱਚੋਂ ਪੈਸੇ ਕੱਢ ਕੇ ਦੇਖਦੀ ਹਾਂ ਤਾਂ ਮਨ ਨੂੰ ਬੜੀ ਖੁਸ਼ੀ ਹੁੰਦੀ ਵੀ ਮੇਰੇ ਬਚਪਨ ਵਿੱਚ ਇਹਨਾਂ ਚੀਜ਼ਾਂ ਦੀ ਕਿੰਨੀ ਅਹਿਮੀਅਤ ਸੀ ਹੁਣ ਅੱਜ ਕੱਲ੍ਹ ਮਹਿੰਗਾਈ ਹੋ ਗਈ ਇਹਨਾਂ ਚੀਜ਼ਾਂ ਦੀ ਅਹਿਮੀਅਤ ਨਹੀਂ ਹੈ ਅੱਗੇ ਪਹਿਲੇ ਟਾਇਮ ਦੇ ਵਿੱਚ ਪੱਚੀ ਪੈਸੇ ਦੀ ਵਧੀਆ ਇੱਕ ਟੋਫੀ ਕੁਲਫੀ ਆ ਜਾਂਦੀ ਹੁੰਦੀ ਸੀ ਡੰਡੇ ਵਾਲੀ ਉਹਦੇ ਵਿੱਚ ਜਿਵੇਂ ਕਿ ਲੈਚੀ ਫਲੇਵਰ ਆ ਜਾਂਦਾ ਸੀ ਔ ਔਰੇਂਜ ਦਾ ਆ ਜਾਂਦਾ ਸੀ ਜਾਂ ਕੋਕਾ ਕੋਲਾ ਦਾ ਆ ਜਾਂਦਾ ਸੀ ਅਤੇ ਬਹੁਤ ਵਧੀਆ ਦਿਨ ਸੀ ਉਹ ਬਹੁਤ ਵਧੀਆ ਲੱਗਦਾ ਸੀ ਉਹ ਹੁਣ ਵੀ ਮੈਂ ਆਪਣੇ ਕੋਲ ਸਾਂਭੇ ਹੋਏ ਨੇ ਤਾਂ ਹੁਣ ਵੀ ਕਦੀ ਕਦੀ ਮੈਂ ਆਪਣੇ ਬੇਟੇ ਨੂੰ ਦਿਖਾਉਂਦੀ ਹਾਂ ਵੀ ਬੇਟਾ ਦੇਖ ਇਹ ਮੇਰੇ ਕੋਲ ਸੀ ਤੇ ਇਹਨਾਂ ਚੀਜ਼ਾਂ ਦੀ ਉਦੋਂ ਵੀ ਮਤਲਬ ਇਹ ਮੰਮੀ ਤੁਸੀਂ ਕੀ ਇੱਦਾਂ ਦੀਆਂ ਗੱਲਾਂ ਕਰਦੇ ਰਹਿੰਨੇ ਹੁੰਦੇ ਹਾਂ ਵੀ ਇਹ ਹੈ ਇਹਨਾਂ ਪੈਸਿਆਂ ਦਾ ਕੀ ਆਉਂਦਾ ਕੁਛ ਨਹੀਂ ਹੁੰਦਾ ਹੈਗਾ ਹੈ ਤਾਂ ਉਹਨੂੰ ਮੈਂ ਕਹਿੰਦੀ ਹਾਂ ਵੀ ਬੇਟੇ ਇਹਨਾਂ ਚੀਜ਼ਾਂ ਦੀ ਬਹੁਤ ਅਹਿਮੀਅਤ ਸੀ ਉਸ ਟਾਈਮ 'ਤੇ ਹੁਣ ਅਤੇ ਇਹਨਾਂ ਪੈਸਿਆਂ ਦੀ ਹੈ ਨਹੀਂ ਅਹਿਮੀਅਤ ਪਰ ਬਹੁਤ ਅਹਿਮੀਅਤ ਸੀ ਉਸ ਟਾਈਮ 'ਤੇ